ਹਾਂ ਇਹੋ ਜਿਹੇ ਦਿਨ ਵੀ ਹਨ ਜਦੋਂ ਮੈਂ ਬਣਾਉਣਾ ਨਹੀਂ ਚਾਹੁੰਦਾ ਇਸ ਦੇ ਕਈ ਕਾਰਨ ਹੋ ਸਕਦੇ ਹਨ ਥਕਾਵਟ ਕਦੇ ਕਦੇ ਮੈਂ ਥੱਕ ਜਾਂਦਾ ਹਾਂ ਅਤੇ ਬਣਾਉਣ ਲਈ ਉਤਸਾਹ ਨਹੀਂ ਹੁੰਦਾ ਪ੍ਰੇਰਨਾ ਦੀ ਘਾਟ ਕਦੇ ਕਦੇ ਮੈਨੂੰ ਪ੍ਰੇਰਨਾ ਨਹੀਂ ਮਿਲਦੀ ਅਤੇ ਮੈਂ ਬਣਾਉਣ ਲਈ ਸੋਚ ਨਹੀਂ ਸਕਦਾ ਹੋਰ ਪ੍ਰਧਾਨ ਤਾਵਾਂ ਕਦੇ ਕਦੇ ਮੈਨੂੰ ਹੋਰ ਕੰਮ ਨੂੰ ਪੂਰਾ ਕਰਨ ਨਾ ਪੈਂਦਾ ਹੈ ਅਤੇ ਬਣਾਉਣ ਲਈ ਸਮਾਂ ਨਹੀਂ ਮਿਲਦਾ ਪ੍ਰੇਰਨਾ ਪ੍ਰਾਪਤ ਕਰਨ ਲਈ ਕਲਾਕਾਰਾਂ ਦੀਆਂ ਰਚਨਾਵਾਂ ਦੇਖਣਾ ਕਲਾ ਦੀਆਂ ਕਿਤਾਬਾਂ ਪੜ੍ਹਨਾ ਕਲਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਦੋਸਤਾਂ ਅਤੇ ਪਰਿਵਾਰ ਤੋਂ ਸਮਰਥਨ ਰੋਜ਼ਾਨਾ ਨਿੱਤ ਹੋਰ ਕੰਮ ਕੰਮਾਂ ਦੀ ਕੰਮਾਂ ਅਤੇ ਚਿੱਤਰਕਾਰੀ ਦਾ ਪ੍ਰਬੰਧ ਸਮਾਂ ਸੂਚੀ ਬਣਾਉਣਾ ਪਰਦਨਾ ਨਾਤਮਾ ਨੂੰ ਨਿਰਧਾਰਿਤ ਕਰਨਾ ਛੋਟੇ ਛੋਟੇ ਬਰੇਕ ਲੈਣਾ ਆਪਣੇ ਆਪ ਨੂੰ ਪ੍ਰੇਰਿਤ ਕਰਨਾ